ਮੇਰਾ ਫੇਵਰਟ ਸ਼ੋਅ ਹੈ ਫ੍ਰੈਡਜ਼ ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਫ੍ਰੈਡਜ਼ ਫ੍ਰੈਂਡ ਮਤਲਬ ਦੋਸਤ ਦੋਸਤ ਆਪਣੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਅਤੇ ਇਸ ਸ਼ੋਅ ਵਿੱਚ ਵੀ ਇਹੀ ਦਰਸਾਇਆ ਗਿਆ ਹੈ ਕਿ ਦੋਸਤ ਕਿਵੇਂ ਆਪਣੇ ਜ਼ਿੰਦਗੀ 'ਚ ਅਣਜਾਣ ਵਿਅਕਤੀ ਬਣ ਕੇ ਆਉਂਦੇ ਹਨ ਅਤੇ ਕਿਸ ਤਰ੍ਹਾਂ ਇੰਨਾ ਅਹਿਮ ਹਿੱਸਾ ਬਣ ਜਾਂਦੇ ਹਨ ਦੋਸਤ ਕਿਵੇਂ ਮਿਲ ਜੁਲ ਕੇ ਰਹਿੰਦੇ ਹਨ ਅਤੇ ਹਰੇਕ ਹੀ ਮੋੜ 'ਤੇ ਉਹ ਬਹੁਤ ਹੀ ਸਪੋਰਟਿਵ ਹੁੰਦੇ ਹਨ ਅਤੇ ਹੈਲਪਫੁੱਲ ਹੁੰਦੇ ਹਨ ਦੋਸਤ ਜੋ ਹੁੰਦੇ ਨੇ ਉਹ ਮਜ਼ਾਕ ਵੀ ਤੁਹਾਡਾ ਸਭ ਤੋਂ ਵੱਧ ਉਡਾਉਂਦੇ ਹਨ ਪਰ ਜਦੋਂ ਕੋਈ ਮੁਸ਼ਕਿਲ ਦੀ ਘੜੀ ਆ ਜਾਵੇ ਤਾਂ ਸਭ ਤੋਂ ਪਹਿਲਾਂ ਖੜ੍ਹਕੇ ਵੀ ਉਹੀ ਦਿਖਾਉਂਦੇ ਹਨ ਨਾਲ਼ ਅਤੇ ਦੋਸਤਾਂ ਨਾਲ਼ ਆਪਾਂ ਫੈਮਿਲੀ ਦੀ ਪ੍ਰੋਬਲਮਜ਼ ਵੀ ਸ਼ੇਅਰ ਕਰ ਸਕਦੇ ਹਨ ਜੋ ਕਿ ਆਪਾਂ ਫੈਮਿਲੀ ਨਾਲ਼ ਵੀ ਨਹੀਂ ਕਰ ਸਕਦੇ ਤੋਂ ਫ੍ਰੈਡਜ਼ ਜੋ ਹੁੰਦੇ ਹਨ ਉਹ ਆਪਣੀ ਇੱਕ ਫੈਮਿਲੀ ਹੀ ਬਣ ਜਾਂਦੇ ਹਨ ਤਾਂ ਤਾਂ ਇਸ ਸ਼ੋਅ 'ਚ ਵੀ ਇਹੀ ਦੱਸਿਆ ਹੋਇਆ ਹੈ ਕਿ ਕਿਵੇਂ ਆਪਾਂ ਫ੍ਰੈਡਜ਼ ਨਾਲ਼ ਰਹਿੰਦੇ ਹਾਂ ਮਿਲ ਜੁਲ ਕੇ ਅਤੇ ਲਾਈਫ਼ ਫ੍ਰੈਡਜ਼ ਤੋਂ ਬਿਨਾ ਕੁਛ ਵੀ ਨਹੀਂ ਹੈ ਤਾਂ ਫ੍ਰੈਡਜ਼ ਜੋ ਹੈ ਉਹ ਆਪਣੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਹਨ